ਖਾਣਾ ਪਕਾਉਣ ਲਈ ਜਿਹੜੀਆਂ ਜੜੀਆਂ ਬੂਟੀਆਂ ਦੀ ਵਰਤੋਂ ਮੇਰੇ ਵੱਲੋਂ ਕੀਤੀ ਜਾਂਦੀ ਹੈ ਆਪਣੇ ਘਰ ਦੇ ਗਮਲਿਆਂ ਦੇ ਵਿੱਚ ਹੀ ਧਨੀਆ ਧਨੀਏ ਤੋਂ ਇਲਾਵਾ ਆਪਣੇ ਜੋ ਕੜ੍ਹੀ ਪੱਤਾ ਕਿ ਕੜ੍ਹੀ ਪੱਤੇ ਦੇ ਨਾਲ ਆਪਣੀ ਸੁੰਡ ਆਦਿ ਜੜੀ ਬੂਟੀਆਂ ਮੈਂ ਆਪਣੇ ਘਰ ਹੀ ਵਿੱਚ ਉਗਾਈਆਂ ਹੋਈਆਂ ਪੁਦੀਨਾ ਵੀ ਹੈ ਜੋ ਕਿ ਮੈਨੂੰ ਜਿਸ ਤਰ੍ਹਾਂ ਤਰੀਕੇ ਦੀ ਲੋੜ ਹੁੰਦੀ ਹੈ ਮੈਂ ਉਸ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਵਰਤੋਂ ਵਿੱਚ ਲੈ ਆਉਂਦਾ ਅਤੇ ਰੂਟੀਨ ਦੇ ਵਿੱਚ ਹੀ ਆਪਣੇ ਜੀਵਨ ਕਾਲ ਦੇ ਵਿੱਚ ਜਿਹੜੀ ਚੀਜ਼ ਦੀ ਮੈਨੂੰ ਲੋੜ ਹੈ ਉਹ ਮੈਂ ਵਰਤਦਾ ਅਜਵਾਇਣ ਨੂੰ ਵੀ ਮੈਂ ਆਪਣੇ ਘਰ ਦੇ ਵਿੱਚ ਗਮਲਿਆਂ ਦੇ ਵਿੱਚ ਜੜੀ ਬੂਟੀ ਦੇ ਤੌਰ 'ਤੇ ਲਗਾਇਆ ਹੋਇਆ ਜੋ ਕਿ ਮੈਂ ਰੂਟੀਨ ਦੇ ਵਿੱਚ ਹੀ ਉਸਦੀ ਵਰਤੋਂ ਕਰ ਰਿਹਾ ਤਾਂ ਜੋ ਮੈਨੂੰ ਅਜਵਾਇਣ ਜੋ ਹੈ ਸਰੀਰ ਨੂੰ ਪੇਟ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਪੇਟ ਦੀ ਬਿਮਾਰੀਆਂ ਤੋਂ ਸੁਰੱਖਿਅਤ ਰੱਖਦੀ ਹੈ ਇਸ ਦੇ ਨਾਲ ਹੀ ਪੁਦੀਨਾ ਜਿਹੜਾ ਉਹ ਉਹਦੀ ਤਸੀਰ ਠੰਢੀ ਹੋਣ ਕਰਕੇ ਉਹ ਗਰਮੀ ਦੇ ਵਿੱਚ ਮੌਸਮ ਦੇ ਵਿੱਚ ਸਰੀਰ ਨੂੰ ਠੰਢਕ ਦਾ ਅਹਿਸਾਸ ਕਰਾਉਂਦਾ ਹੈ ਅਤੇ ਇਸ ਤੋਂ ਇਲਾਵਾ ਜਿਹੜਾ ਧਨੀਆ ਹੈ ਉਹ ਵੀ ਉਹਦੀ ਤਸੀਰ ਵੀ ਠੰਢੀ ਹੋਣ ਕਰਕੇ ਉਹ ਠੰਢਕ ਦਾ ਅਹਿਸਾਸ ਜਿਹੜਾ ਸਰੀਰ ਨੂੰ ਕਰਾਉਂਦਾ ਅਤੇ ਇਹਦੇ ਨਾਲ ਹੀ ਇਹ ਜਿਹੜੀ ਜੜੀ ਬੂਟੀਆਂ ਹੈ ਮੈਂ ਆਪਣੇ ਹੋਰ ਸਾਥੀਆਂ ਨੂੰ ਵੀ ਚਾਹੁੰਦਾ ਵੀ ਘਰ ਘਰ ਦੇ ਵਿੱਚ ਹੀ ਜੜੀ ਬੂਟੀਆਂ ਆਪਣੇ ਰੂਟੀਨ ਅਤੇ ਜੀਵਨ ਦੇ ਵਿੱਚ ਡੇਲੀ ਰੋਜ਼ਮੱਰਾ ਦੀ ਜ਼ਿੰਦਗੀ ਦੇ ਵਿੱਚ ਵਰਤਣੀਆਂ ਚਾਹੀਦੀਆਂ